ਪੰਜਾਬ ਦੀ ਆਰਥਿਕਤਾ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਬਹੁਤ ਅਹਿਮ ਭੂਮਿਕਾ ਹੈ ਜਿਵੇਂ ਕੀ ਜੀ ਡੀ ਪੀ ਨਾਲ ਆਰਥਿਕਤਾ ਵਿੱਚ ਕਾਫੀ ਇੰਪਰੂਵਮੈਂਟ ਆ ਸਕਦੀ ਹੈ ਜਿਹੜਾ ਇਨਸਾਨ ਆ ਉਹ ਆਪਣਾ ਰੁਜ਼ਗਾਰ ਚਲਾ ਸਕਦਾ ਹੈ ਜਿਸ ਨਾਲ ਉਸਦੇ ਬੱਚਿਆਂ ਨੂੰ ਵਧੀਆ ਫਿਊਚਰ ਔਰ ਐਜੂਕੇਸ਼ਨ ਮਿਲ ਸਕਦੀ ਹੈ ਅਤੇ ਆਪਣਾ ਘਰ ਦਾ ਖਰਚਾ ਵਧੀਆ ਚਲਾ ਸਕਦਾ ਹੈ